ਹੈਲੋ ਹਾਂਜੀ ਮੈਂ ਕਨਿਸ਼ਕਾ ਬੋਲ ਰਹੀ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਆਪਣੀ ਫੈਮਿਲੀ ਨਾਲ ਜਾਂਦੀ ਰਹਿੰਦੀ ਨਹੀਂ ਆਏ ਸੰਡੇ ਚਲੋ ਜਦੋਂ ਵੀ ਮੈਨੂੰ ਛੁੱਟੀ ਹੁੰਦੀ ਆ ਤਾਂ ਮੈਨੂੰ ਫੂਡਿੰਗ ਫੂਡ ਖਾਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸਪੈਸ਼ਲੀ ਆਪਾਂ ਓਇਲੀ ਫੂਡ ਜਦੋਂ ਖਾਂਦੇ ਹਾਂ ਫਾਸਟ ਫੂਡ ਉਹਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਸਰ ਮਾਨਸਾ ਬਹੁਤ ਸਾਰੇ ਦੁਕਾਨ ਨੇਗੀਆਂ ਬਹੁਤ ਸਾਰੀਆਂ ਸ਼ੋਪਸ ਨੇਗੀਆਂ ਜੋ ਵਧੀਆ ਵਧੀਆ ਫੂਡ ਪ੍ਰੋਵਾਈਡ ਕਰਦੇ ਨੇ ਆਪਾਂ ਨੂੰ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਨੇਗੇ ਜੀ ਜਿਵੇਂ ਬਹੁਤ ਜ਼ਿਆਦਾ ਸਵੀਟਸ ਜਿਵੇਂ ਬਰਾੜ ਸਵੀਟਸ ਹੋ ਗਿਆ ਬਹੁਤ ਜ਼ਿਆਦਾ ਫਾਸਟ ਫੂਡ ਹੁੰਦਾ ਉੱਥੇ ਵੀ ਜਿਵੇਂ ਨਿੱਕੀ ਭੰਡਾਰ ਹੋ ਗਿਆ ਉਹ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੀ ਹੈ ਜੇ ਤੁਸੀਂ ਬਸ ਸਟੈਂਡ ਤੋਂ ਤੁਹਾਨੂੰ ਬਾਹਲੀ ਦੂਰ ਨਹੀਂ ਜਾਣਾ ਤਾਂ ਨਿੱਕੀ ਭੰਡਾਰ ਨੇੜੇ ਪਊ ਤੁਹਾਨੂੰ ਨਾਲੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਗਾ ਉਹਦਾ ਸੁਬਾਹ ਤੋਂ ਲੈ ਕੇ ਐਂ ਕਹਿ ਲਓ ਸ਼ਾਮ ਤੱਕ ਲਾਈਨ ਲੱਗੀ ਹੁੰਦੀ ਉਹਦੇ ਫਾਸਟ ਫੂਡ ਵੀ ਬਹੁਤ ਅੱਛਾ ਬਣਾਉਂਦਾ ਬਿਲਕੁਲ ਬਿਲਕੁਲ ਸਾਰੇ ਹੀ ਸਾਫ਼ ਸਫ਼ਾਈ ਸਭ ਸਾਫ਼ ਸਫ਼ਾਈ ਨਾਲ ਸਾਰਾ ਕੰਮ ਹੁੰਦਾ ਹਰ ਇੱਕ ਚੀਜ਼ ਵਧੀਆ ਸਾਫ਼ ਸਫ਼ਾਈ ਨਾਲ ਪ੍ਰੋਵਾਈਡ ਕਰਦੇ ਆ ਉਹ ਡਿਸੀਪਲਨ ਬਹੁਤ ਅੱਛਾ ਹੈਗਾ ਹਰ ਕਸਟਮਰ ਨੂੰ ਬਹੁਤ ਵਧੀਆ ਤਰੀਕੇ ਨਾਲ ਟਰੀਟ ਕਰਦੇ ਆ ਟਾਈਮ ਟੂ ਟਾਈਮ ਹਰ ਕੋਲ ਆਉਂਦੇ ਨੇਗੇ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਇਕ ਨੂੰ ਹੀ ਧਿਆਨ ਨਾਲ ਨੋਟ ਕਰਦੇ ਆ ਠੀਕ ਹੈ ਵੀ ਇੱਕ ਵੱਲ ਹੀ ਧਿਆਨ ਦਿੰਦੇ ਹੈਗੇ ਨੇ ਸਭ ਕਸਟਮਰ ਵੱਲ ਆਉਂਦੇ ਆ ਉਹਨਾਂ ਕੋਲ ਸਟਾਫ਼ ਵੀ ਬਹੁਤ ਵਧੀਆ ਰੱਖਿਆ ਹੋਇਆ ਹੈਗਾ ਬਿਲਕੁਲ ਬਿਲਕੁਲ ਬਿਲਕੁਲ ਰੇਟ ਕੋਈ ਜ਼ਿਆਦਾ ਆਪਾਂ ਐਂ ਕਹੀਏ ਐਕਸਪੈਂਸਿਵ ਨਹੀਂ ਹੈਗਾ ਇਕਨੋਮਿਕ ਹੀ ਹੈ ਜ਼ਿਆਦਾ ਆਪਾਂ ਕਹਿ ਦੇਈਏ ਵੀ ਬਾਹਲਾ ਕੋਸਟਲੀ ਨਹੀਂ ਹੈਗਾ ਸਮਾਨ ਬਟ ਹਾਂ ਕੁਆਲਿਟੀ ਵਧੀਆ ਖਾਣਾ ਵਧੀਆ ਟੇਸਟ ਬਹੁਤ ਵਧੀਆ ਪ੍ਰਾਈਜ ਵੀ ਠੀਕ ਹੈ ਕੰਫਰਟੇਬਲ ਆ ਪ੍ਰਾਈਜ ਵੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਉੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਲੋਗਰ ਆਉਂਦੇ ਆ ਜੋ ਵੀਡੀਓ ਬਣਾਉਂਦੇ ਨੇ ਅਤੇ ਉਹਨਾਂ ਦਾ ਹੋਟਲ ਵੀ ਤਾਂਹੀਓ ਤੁਹਾਨੂੰ ਐਵੇਂ ਕਹਾਂ ਵੀਡੀਓ ਬਣਾਉਣ ਕਰਕੇ ਬਹੁਤ ਜ਼ਿਆਦਾ ਫੇਮਸ ਹੋਇਆ ਬਾਹਰੋਂ ਬਾਹਰੋਂ ਲੋਕ ਆਉਂਦੇ ਨੇਗੇ ਬਠਿੰਡਾ ਹੋ ਗਿਆ ਜਲੰਧਰ ਹੋ ਗਿਆ ਬਹੁਤ ਜਗ੍ਹਾ ਤੋਂ ਆਉਂਦੇ ਇੱਥੇ ਖਾਣ ਲਈ ਬਲੋਗਸ ਵੀ ਬਹੁਤ ਬਣਾਉਂਦੇ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂਜੀ ਬਿਲਕੁਲ ਕਿੰਨ ਕਿੰਨੇ ਮਰਜ਼ੀ ਟਾਈਮ ਬਣਾਓ ਵੀਡੀਓ ਬਿਲਕੁਲ ਔਫਕੋਸ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀਆਂ ਕਿੱਦਾਂ ਮਰਜ਼ੀ ਬਣਾ ਸਕਦੇ ਹੋ ਵੀਡੀਓਜ਼ ਤੁਸੀਂ ਹਾਂਜੀ ਹਾਂਜੀ ਥੈਂਕ ਯੂ